ਅਸੀਂ ਅਸ ਮੈਨੂੰ ਯਾਤਰਾ ਕਰਨ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਆਪਣੇ ਸ਼ਹਿਰ ਜਾਂ ਰਾਜਾਂ ਦੀ ਯਾਤਰਾ ਕਰਦੀ ਹੀ ਰਹਿੰਦੀ ਹਾਂ ਅਤੇ ਜਦੋਂ ਮੈਂ ਯਾਤਰਾ ਦੌਰਾਨ ਕਿਸੇ ਵੀ ਦੂਜੇ ਰਾਜ ਜਾਂ ਸ਼ਹਿਰ ਵਿੱਚ ਜਾਂਦੀ ਹਾਂ ਤਾਂ ਮੈਨੂੰ ਇਹ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਜੇਬ ਕਤਰਾ ਮੇਰੀ ਜੇਬ ਹੀ ਨਾ ਕੱਟ ਦੇਵੇ ਜਾਂ ਫਿਰ ਮੇਰੀ ਮੇਰੀ ਗਲ ਵਿੱਚ ਪਾਈ ਚੈ ਸੋਨੇ ਦੀ ਚੈਨ ਜਾਂ ਵਾਲ਼ੀਆਂ ਹੀ ਨਾ ਲਾਹ ਕੇ ਲੈ ਜਾਵੇ ਅਤੇ ਜਦੋਂ ਮੈਂ ਕਿਤੇ ਵੀ ਕਿਤੇ ਵੀ ਰਹਿਣ ਲਈ ਰੂਮ ਰੂਮ ਲੈਂਦੀ ਹਾਂ ਤਾਂ ਮੈਨੂੰ ਇਹ ਵੀ ਡਰ ਬਣਿਆ ਰਹਿੰਦਾ ਹੈ ਕਿ ਕੋਈ ਸੀਸੀਟੀਵੀ ਕੈਮਰਾ ਉਸ ਕਮਰੇ ਵਿੱਚ ਨਾ ਲੱਗਿਆ ਹੋਵੇ ਕਿਉਂਕਿ ਅੱਜ ਕੱਲ੍ਹ ਦਾ ਯੁੱਗ ਬਲੈਕਮੇਲ ਦਾ ਯੁੱਗ ਹੈ ਅਤੇ ਬਹੁਤ ਹੀ ਜ਼ਿਆਦਾ ਲੋਕ ਸੀਸੀਟੀਵੀ ਕੈਮਰਿਆਂ ਕੈਮਰਿਆਂ ਰਾਹੀਂ ਹੀ ਲੋਕਾਂ ਨੂੰ ਸਪੈਸ਼ਲੀ ਕੁੜੀਆਂ ਨੂੰ ਕੁੜੀਆਂ ਨੂੰ ਬਲੈਕਮੇਲ ਕਰ ਰਹੇ ਹਨ